ਹੈਲੋ ਹੈਲੋ ਅਮਨ ਅਮਨ ਬੋਲ ਰਹੇ ਅਮਨ ਗੁਡ ਆਫਟਰਨੂਨ ਅਮਨ ਐਕਚੁਲੀ ਅਸੀਂ ਇੱਥੋਂ ਹੀ ਗਏ ਸੀ ਪੰਜਾਬ ਤੋਂ ਹੀ ਮੇਰੇ ਪਾਪਾ ਜੋਬ ਕਰਦੇ ਆ ਹੁਣ ਉੱਥੇ ਓਡੀਸ਼ਾ ਦੇ ਵਿੱਚ ਅਤੇ ਤੁਸੀਂ ਮੇਰੇ ਨਾਲ ਪੰਜਾਬੀ ਦੇ ਵਿੱਚ ਗੱਲ ਕਰ ਸਕਦੇ ਹੋ ਕੋਈ ਚੱਕਰ ਨਹੀਂ ਹਾਂਜੀ ਹਾਂਜੀ ਮੇਰੇ ਪਾਪਾ ਦਾ ਨਾਮ ਨਿਸ਼ਾਨ ਸਿੰਘ ਹੈ ਅਤੇ ਉਹ ਤੁਹਾਡੇ ਪਾਪਾ ਦੇ ਫਰੈਂਡ ਨੇ ਅਤੇ ਫਿਰ ਮੈਨੂੰ ਅੰਕਲ ਨੇ ਨੰਬਰ ਦਿੱਤਾ ਸੀ ਤੁਹਾਡਾ ਉਹ ਕਹਿੰਦੇ ਨਾ ਵੀ ਮੇਰੀ ਬੇਟੀ ਉੱਥੇ ਪੜ੍ਹਦੇ ਮੇਰੇ ਨਾ ਐਕਚੁਲੀ ਪਾਪਾ ਦਾ ਇੱਥੇ ਟ੍ਰਾਂਸਫਰ ਹੋ ਗਿਆ ਅਤੇ ਹੁਣ ਮੈਂ ਇੱਥੇ ਕਾਲਜ ਜੋਆਇਨ ਕਰਨਾ ਅਤੇ ਤਾਂ ਕਰਕੇ ਮੈਂ ਫਿਰ ਉਹ ਕਹਿੰਦੇ ਸੀ ਵੀ ਉੱਥੇ ਮੇਰੀ ਬੇਟੀ ਪੜ੍ਹ ਰਹੀ ਜਿਹੜੇ ਕਾਲਜ ਵਿੱਚ ਤੁਸੀਂ ਪੜ੍ਹ ਰਹੇ ਹੋ ਅਤੇ ਉੱਥੇ ਮੈਂ ਜੁਆਇਨ ਕਰਨਾ ਆ ਕੇ ਅਤੇ ਇਸ ਲਈ ਮੈਨੂੰ ਫਿਰ ਤੁਹਾਡੇ ਪਾਪਾ ਨੇ ਇਹ ਨੰਬਰ ਦਿੱਤਾ ਸੀਗਾ ਮੈਨੂੰ ਤੁਹਾਡਾ ਕਹਿ ਰਹੇ ਸੀ ਵੀ ਉੱਥੇ ਅਮਨ ਨਾਲ ਗੱਲ ਕਰ ਲਿਓ ਜੀ ਅਤੇ ਜੇ ਕੋਈ ਤੁਹਾਨੂੰ ਪ੍ਰੋਬਲਮ ਹੋਵੇ ਕਿਸੇ ਚੀਜ਼ ਦੀ ਲੋੜ ਹੋਵੇ ਹੈ ਨਾ ਅਤੇ ਤੁਹਾਡੇ ਨਾਲ ਗੱਲ ਕਰਕੇ ਉਹ ਸੋਲਵ ਹੋ ਜੂਗੀ ਅਤੇ ਮੈਂ ਤੁਹਾਨੂੰ ਇਹ ਪੁੱਛਣਾ ਸੀਗਾ ਵੀ ਮੈਂ ਆ ਰਿਹਾ ਵੀ ਨੈਕਸਟ ਮੈਂ ਮੰਥ ਆ ਰਿਹਾ ਅਤੇ ਇੱਥੋਂ ਦਾ ਸਭ ਤੋਂ ਪਹਿਲਾਂ ਤਾਂ ਮੈਨੂੰ ਵੈਦਰ ਬਾਰੇ ਦੱਸੋ ਵੀ ਵੈਦਰ ਕਿੱਦਾਂ ਦਾ ਇੱਥੋਂ ਦਾ ਠੀਕ ਹੈ ਜੀ ਅੱਛਾ ਅੱਛਾ ਠੀਕ ਹੈ ਅੱਛਾ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਂ ਨਾ ਇਹ ਹੀ ਪੁੱਛਣਾ ਸੀਗਾ ਤੁਹਾਡੇ ਤੋਂ ਵੀ ਮੈਂ ਹਾਂ ਵੀ ਮੈਂ ਕਲੋਥਸ ਕਿੱਦਾਂ ਦੇ ਲੈ ਕੇ ਆਵਾਂ ਅ ਵੀ ਉਹ ਇਹ ਨਾ ਹੋਵੇ ਮੈਂ ਹੈ ਨਾ ਵੀ ਕੋਈ ਆਪਣੇ ਠੰਡ ਵਾਲੇ ਚੱਕ ਲਾਂ ਜਾਂ ਜ਼ਿਆਆ ਗਰਮੀ ਵਾਲੇ ਚੱਕ ਲਾਂ ਮੈਂ ਤਾਂ ਹੀ ਪੁੱਛ ਰਿਹਾ ਇੱਥੋਂ ਤਾਂ ਵੈਦਰ ਮੈਨੂੰ ਦੱਸ ਦਿਓ ਫਿਰ ਮੈਂ ਉਸ ਹਿਸਾਬ ਨਾਲ ਆਪਣੇ ਪੈਕ ਕਰੂੰਗਾ ਕਲੋਥਸ ਅੱਛਾ ਗਰਮੀ ਚੱਲ ਰਹੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਅੱਛਾ ਠੀਕ ਹੈ ਨਹੀਂ ਕੋਈ ਗੱਲ ਨਹੀਂ ਹਾਂ ਅਤੇ ਬਾਕੀ ਇੱਥੇ ਹੋਸਟਲ ਦੇ ਵਿੱਚ ਕਿੱਦਾਂ ਦਾ ਖਾਣਾ ਪ੍ਰੋਵਾਈਡ ਹੁੰਦਾ ਮੈਨੂੰ ਉਹਦੇ ਬਾਰੇ ਵੀ ਦੱਸ ਦਿਓ ਜੀ ਫਿਰ ਕਿਉਂਕਿ ਮੈਂ ਇੰਨੀ ਦੂਰੋਂ ਆਉਣਾ ਫਿਰ ਕਈ ਵਾਰ ਕਿ ਕਿਸੇ ਜਗ੍ਹਾ ਦਾ ਖਾਣਾ ਉਹ ਨਹੀਂ ਆਪਾਂ ਨੂੰ ਡਾਈਜੈਸਟ ਹੁੰਦਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ

ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਓਕੇ ਠੀਕ ਹੈ ਠੀਕ ਹੈ ਓਕੇ ਓਕੇ ਹਾਂ ਮੈਨੂੰ ਮੋਸਟਲੀ ਤਾਂ ਮੈਂ ਇਹਦਾ ਵੈਦਰ ਦਾ ਹੀ ਪੁੱਛਣਾ ਸੀ ਕਿਉਂਕਿ ਇੱਥੇ ਸਾਡੇ ਵੀ ਕਾਫੀ ਜਦੋਂ ਗਰਮੀ ਪੈਂਦੀ ਕਾਫੀ ਗਰਮੀ ਪੈਂਦੀ ਬਟ ਸਰਦੀ ਵੀ ਜ਼ਿਆਦਾ ਪੈਂਦੀ ਆ ਮੈਂ ਤਾਂ ਕਰਕੇ ਮੈਂ ਤੁਹਾਨੂੰ ਕਾਲ ਕੀਤਾ ਵੀ ਮੈਨੂੰ ਬਸ ਵੀ ਮੇਨਲੀ ਵੈਦਰ ਦਾ ਆ ਵੈਦਰ ਦੇ ਵਿੱਚ ਆਪਣੇ ਆਪ ਨੂੰ ਢਾਲਣਾ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਹੁੰਦਾ ਠੀਕ ਹੈ ਜੀ ਓਕੇ ਓਕੇ ਥੈਂਕ ਯੂ ਅਮਨ ਓਕੇ ਬਾਏ